ਹੈਲੋ ਸਵਿੱਗੀ ਤੋਂ ਗੱਲ ਕਰ ਰਿਹਾ ਜੀ ਗੁਰਜੰਟ ਸਿੰਘ ਗੱਲ ਕਰ ਰਿਹਾ ਜੀ ਮੈਂ ਸਰ ਖਾਣਾ ਆਰਡਰ ਕੀਤਾ ਹੋਇਆ ਸੀਗਾ ਅਤੇ ਜਿਸ ਵਿੱਚ ਆਲੂ ਮਟਰ ਪਨੀਰ ਦੀ ਭੁਰਜੀ ਸਾਹੀ ਪਨੀਰ ਹਾਂਜੀ ਇੰਨੀਆਂ ਚੀਜ਼ਾਂ ਸੀਗੀਆਂ ਅਤੇ ਆਪਣਾ ਮੈਂ ਤੁਹਾਡੇ ਨਾ ਵੇਟ ਕਰ ਰਿਹਾ ਸੀ ਖਾਣੇ ਦੀ ਗੈਸਟ ਆਏ ਹੋਏ ਸੀ ਅਤੇ ਜਿੰਨਾ ਤੁਸੀਂ ਸਮਾਂ ਦਿੱਤਾ ਹੋਇਆ ਸੀਗਾ ਉਸ ਤੋਂ ਉੱਤੇ ਟਾਈਮ ਹੋ ਗਿਆ ਅਤੇ ਅਜੇ ਤੱਕ ਤੁਹਾਡਾ ਆ ਪਹੁੰਚਿਆ ਨਹੀਂ ਹੈਗਾ ਤੁਹਾਡਾ ਡਿਲੀਵਰੀ ਵਾਲਾ ਅਤੇ ਤੁਸੀਂ ਕਿਰਪਾ ਕਰਕੇ ਭੇਜਣ ਵਾਲੇ ਨਾਲ ਸੰਪਰਕ ਕਰਕੇ ਅਤੇ ਮੈਨੂੰ ਕਨਫਰਮ ਕਰੋ ਵੀ ਕਿੰਨੇ ਟਾਈਮ ਤੱਕ ਪਹੁੰਚ ਜਾਵੇਗਾ ਜੇ ਉਹ ਆਪਣੇ ਸ ਨਿਰਧਾਰਤ ਸਮੇਂ 'ਤੇ ਨਹੀਂ ਪਹੁੰਚ ਸਕਿਆ ਤੇ ਜੇ ਫਿਰ ਉਹਦਾ ਕੋਈ ਫ਼ਾਇਦਾ ਨਹੀਂ ਹੋਣਾ ਕਿਉਂਕਿ ਪ੍ਰਾਹੁਣਿਆਂ ਨੇ ਫਿਰ ਚਲੇ ਜਾਣਾ ਅਤੇ ਸਮੇਂ ਦੇ ਸਿਰ 'ਤੇ ਉਹਨਾਂ ਨੂੰ ਖਾਣਾ ਵੀ ਦੇਣਾ ਆ ਅਤੇ ਜੇ ਉਹ ਦੇ ਸਕਦੇ ਤਾਂ ਸਮੇਂ 'ਤੇ ਉਹਦੇ ਬਾਰੇ ਮੈਨੂੰ ਕਨਫਰਮ ਕਰਕੇ ਦੱਸੋ ਜੇ ਉਹ ਸਮੇਂ 'ਤੇ ਨਹੀਂ ਆ ਸਕਦਾ ਤਾਂ ਵੀ ਮੈਨੂੰ ਦੱਸੋ ਮੇਰਾ ਔਡਰ ਫਿਰ ਕੈਂਸਲ ਕਰ ਦਿਓ ਅਤੇ ਮੇਰੀ ਪੇਮੈਂਟ ਰਿਟਰਨ ਕਰ ਦਿਓ ਅਤੇ ਮਿਹਰਬਾਨੀ